ਹੈਲੋ ਹਾਂਜੀ ਮੋਨਾ ਕਿਵੇਂ ਹੋ ਵਧੀਆ ਵਧੀਆ ਹੋਰ ਦਿਲ ਲੱਗ ਗਿਆ ਕਿਵੇਂ ਲੱਗਿਆ ਸਾਡਾ ਬਰਨਾਲਾ ਹਾਂ ਹੋਰ ਬੱਚਿਆਂ ਦੀ ਸਕੂਲਿੰਗ ਬਾਰੇ ਕੀ ਸੋਚਿਆ ਹਾਂਜੀ ਮਨਪ੍ਰੀਤ ਹਾਂਜੀ ਹਾਂਜੀ ਮੋਨਾ ਵੈਸੇ ਤਾਂ ਨਾ ਇੱਥੇ ਬਹੁਤ ਸਕੂਲ ਨੇ ਜਿਹੜੇ ਵਧੀਆ ਨੇ ਮੈਂ ਤੁਹਾਨੂੰ ਕਈ ਟੋਪ ਸਕੂਲਾਂ ਦੇ ਨਾਮ ਵੀ ਦੱਸ ਦਿੰਦੀ ਹਾਂ ਜਿਵੇਂ ਇਥੇ ਹੈਗਾ ਵਾਈ ਐਸ ਸਕੂਲ ਹੈ ਮੈਨੂੰ ਮੇਰੇ ਅਕੋਰਡਿੰਗਲੀ ਬਹੁਤ ਅੱਛਾ ਸਕੂਲ ਹੈ ਵਾਈ ਐਸ ਸਕੂਲ ਹੈਗਾ ਸੈਕਰਡ ਹਰਟ ਸਕੂਲ ਹੈਗਾ ਉਹ ਵੀ ਬਹੁਤ ਅੱਛਾ ਹੈ ਸਕੂਲ ਔਰ ਇਸ ਤੋਂ ਇਲਾਵਾ ਇੱਥੇ ਮਦਰ ਟੀਚਰ ਸਕੂਲ ਵੀ ਹੈਗਾ ਇੱਕ ਬੀ ਜੀ ਐਸ ਬਾਬਾ ਗਾਂਧਾ ਸਿੰਘ ਸਕੂਲ ਜਿਹੜੇ ਆ ਉਹ ਵੀ ਬਹੁਤ ਵਧੀਆ ਦੇਖੋ ਹੁਣ ਇਹ ਤੁਹਾਡੀ ਚੋਇਸ ਦੇ ਉੱਤੇ ਵੀ ਤੁਸੀਂ ਕਿਸ ਤਰ੍ਹਾਂ ਦੇ ਸਕੂਲ ਦੇ ਵਿੱਚ ਬੱਚੇ ਨੂੰ ਲਗਾਉਣਾ ਚਾਹੁੰਦੇ ਹੋ ਜਿਵੇਂ ਜਿਹੜਾ ਹਾਂਜੀ ਹੂੰ ਮੇਰੇ ਬੱਚੇ ਵਾਈ ਐਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਅਤੇ ਵੀ ਬੈਸਟ ਵੀ ਬੈਸਟ ਸਕੂਲ ਹੈ ਥੋੜ੍ਹੇ ਬਹੁਤੇ ਦੇਖੋ ਖਰਚੇ ਤਾਂ ਵੱਧ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਜਿਵੇਂ ਜਿਵੇਂ ਸਕੂਲ ਅੱਗੇ ਵੱਧਦੇ ਜਾਂਦੇ ਨੇ ਉਸ ਤਰ੍ਹਾਂ ਉਹਨਾਂ ਦੇ ਖਰਚੇ ਵੀ ਵੱਧਦੇ ਜਾਂਦੇ ਨੇ ਤਾਂ ਵੀ ਪਰ ਸਕੂਲ ਬਹੁਤ ਅੱਛਾ ਹੈ ਪਰ ਜੇ ਤੁਸੀਂ ਬਰਨਾਲੇ ਤੋਂ ਬਾਹਰ ਲਗਾਉਣਾ ਚਾਹੁੰਦੇ ਹੋ ਤਾਂ ਇੱਕ ਲੋਂਗਪੂਰੀ ਸਕੂਲ ਵੀ ਹੈਗਾ ਬਰਨਾਲਾ ਡਿਸਟਰਿਕਟ ਦੇ ਵਿੱਚ ਉਹ ਵੀ ਬਹੁਤ ਅੱਛਾ ਹੈ ਇੰਟਰਨੈਸ਼ਨਲ ਤੱਕ ਲੈਵਲ ਦਾ ਸਕੂਲ ਹੈ ਔਰ ਸਾਰਾ ਕੁਝ ਬੱਚਿਆਂ ਲਈ ਬਹੁਤ ਵਧੀਆ ਹੈਗਾ ਉੱਥੇ ਗੇਮਸ ਸਪੋਰਟਸ ਸਾਰਾ ਕੁਛ ਹੈ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਵਾਈ ਐਸ ਦੇ ਵਿੱਚ ਵੀ ਸਭ ਕੁਛ ਹੈ ਵਾਈ ਐਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਅਤੇ ਔਰ ਬੱਚੇ ਵੀ ਅੱਗੇ ਤੱਕ ਵੀ ਜਾਂਦੇ ਆ ਉਹਨਾਂ ਨੂੰ ਸਪੀਕਿੰਗ ਦੀ ਜਿਹੜੀ ਹੈਗੀ ਕਪੈਸਿਟੀ ਉਹ ਵੀ ਕਾਫ਼ੀ ਜ਼ਿਆਦਾ ਅੱਛੀ ਹੈ ਲਿਸਨਿੰਗ ਪਾਵਰ ਵੀ ਬੱਚਿਆਂ ਦੀ ਬਹੁਤ ਵਧੀਆ ਨੇ ਤੁਸੀਂ ਇੱਕ ਵਾਰ ਵਿਜਿਟ ਕਰਕੇ ਦੇਖ ਲਓ ਸਕੂਲ ਦੇ ਵਿੱਚ ਅਤੇ ਤੁਸੀਂ ਮੇਰੇ ਕਹੇ 'ਤੇ ਇੱਕ ਵਾਰ ਵਾਈ ਐਸ ਸਕੂਲ ਵਿਜਿਟ ਕਰਕੇ ਦੇਖੋ ਮੈਨੂੰ ਲੱਗਦਾ ਵੀ ਤੁਹਾਡੀ ਸੰਤੁਸ਼ਟੀ ਹੋ ਜਾਊਗੀ ਅਤੇ ਤੁਹਾਡੇ ਬੱਚੇ ਉੱਥੇ ਵਧੀਆ ਸੈਟਿਸਫਾਈਡ ਰਹਿਣਗੇ ਹਾਂ ਕੋਈ ਗੱਲ ਨਹੀਂ ਮੈ ਮੋਨਾ ਮੈਨੂੰ ਦੱਸ ਦਿਓ ਅਗਰ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਹੋਇਆ ਤਾਂ ਮੰਡੇ ਮੈਂ ਫਰੀ ਹਾਂ ਆਪਾਂ ਚਲ ਜਾਂਗੇ ਠੀਕ ਹੈ ਓਕੇ ਬਾਏ